ਪੰਜਾਬ ਸਰਕਾਰ ਬਾਲਕਾਂ ਦੀ ਸਿੱਖਿਆ ਲਈ ਬਹੁਤ ਹੀ ਮਹੱਤਵਪੂਰਨ ਕਦਮ ਚੁੱਕ ਰਹੀ ਹੈ ਜਿਵੇਂ ਸਕੂਲਾਂ ਵਿੱਚ ਦੇਖਿਆ ਜਾ ਸਕਦਾ ਕਿ ਉਹਨਾਂ ਨੂੰ ਪੇਂਟਿੰਗ ਕਰਨ ਨਵੀਆਂ ਨਵੀਆਂ ਖੇਡਾਂ ਨਾਲ ਜੋੜਨ ਅਤੇ ਕਿਤਾਬਾਂ ਨਾਲ ਜੋੜਨ ਸਾਹਿਤ ਨਾਲ ਜੋੜਨ ਦਾ ਜੋ ਕੰਮ ਕਰ ਰਹੀ ਹੈ ਬਹੁਤ ਹੀ ਸ਼ਲਾਘਾ ਯੋਗ ਹੈ ਅਤੇ ਜੋ ਬੱਚੇ ਡਰਾਇੰਗ ਕਰਦੇ ਹਨ ਜਾਂ ਖੇਡਾਂ ਨਾਲ ਉਹ ਆਪਣੇ ਮਤਲਬ ਵੱਡੇ ਹੋ ਕੇ ਫਿਊਚਰ ਸਿਕਿਓਰ ਕਰ ਸਕਦੇ ਹਨ ਉਹ ਚੰਗੇ ਇੱਕ ਪੇਂਟਰ ਬਣ ਸਕਦੇ ਹਨ ਡਰਾਇੰਗ ਕਰ ਸਕਦੇ ਹਨ ਪਰ ਨਾਲ ਹੀ ਨਾਲ ਇਹ ਹੈ ਕਿ ਜੋ ਪਿੰਡ ਹਨ ਉਹਨਾਂ ਵਿੱਚ ਲਾਇਬਰੇਰੀ ਹੋਣੀ ਚਾਹੀਦੀ ਹੈ ਅਤੇ ਪਿੰਡ ਪੱਧਰ 'ਤੇ ਨਾ ਲੋਕ ਕਲਾਵਾਂ ਹੋਣੀਆਂ ਚਾਹੀਦੀਆਂ ਹਨ ਲੋਕ ਖੇਡਾਂ ਹੋਣੀਆਂ ਚਾਹੀਦੀਆਂ ਹਨ ਕੁੜੀਆਂ ਲਈ ਸਿਲਾਈ ਕਢਾਈ ਦੇ ਸੈਂਟਰ ਵੀ ਖੋਲ੍ਹੇ ਜਾ ਰਹੇ ਹਨ ਤਾਂ ਜੋ ਵੀ ਉਹ ਵੱਡੀਆਂ ਹੋ ਕੇ ਨਾ ਵੀ ਉਹ ਹੱਥ ਹੱਥੀਂ ਜੋ ਕਲਾ ਹੈ ਨਾ ਉਹਦੇ ਨਾਲ ਆਪਣੀ ਸਕਿਲ ਡਿਵੈਲਪਮੈਂਟ ਕਰ ਸਕਣ ਨਾ ਆਰਥਿਕ ਤੌਰ 'ਤੇ ਮਜ਼ਬੂਤ ਹੋ ਸਕਣ ਪਰ ਪਿੰਡਾਂ ਵਿੱਚ ਜੋ ਮਤਲਬ ਪਿੰਡ ਪੱਧਰ 'ਤੇ ਜੋ ਖੇਡਾਂ ਹੈ ਨਾ ਉਹਨਾਂ ਨੂੰ ਇੰਨਾ ਉਤਸ਼ਾਹ ਨਹੀਂ ਮਿਲ ਰਿਹਾ ਜੋ ਕਿ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਚੰਗੇ ਚੰਗੇ ਇਨਾਮ ਦੇਣੇ ਚਾਹੀਦੇ ਹਨ ਤਾਂ ਜੋ ਨਸ਼ਿਆਂ ਵੱਲ ਨਾ ਜਾਣ ਅਤੇ ਉਹ ਅਪ ਆਪ ਮਿਹਨਤ ਕਰਨ ਨਾ ਹੱਥਾਂ ਨਾਲ ਕੰਮ ਕਰਨ ਅਤੇ ਜੋ ਪਿੰਡਾਂ ਵਿੱਚ ਲਾਇਬਰੇਰੀ ਆ ਜੇ ਉਹ ਖੁੱਲ੍ਹ ਜਾਵੇਗੀ ਤਾਂ ਜਿਹੜੇ ਬੱਚੇ ਆ ਉਹ ਸਾਹਿਤ ਨਾਲ ਜੁੜਨਗੇ ਅਤੇ ਸ ਸਾਡੇ ਸਮਾਜ ਦਾ ਜੋ ਚੰਗਾ ਭਵਿੱਖ ਸਿਰਜ ਸਕਣਗੇ ਪਰ ਇਹ ਸਭ ਕੁਛ ਸਾਰਿਆਂ ਦੇ ਸਹਿਯੋਗ ਨਾਲ ਹੋਊਗਾ ਅਤੇ ਪੰਜਾਬ ਸਰਕਾਰ ਨੂੰ ਮਤਲਬ ਇਹ ਚਾਹੀਦਾ ਕਿ ਪਿੰਡਾਂ ਵਿੱਚ ਲਾਇਬਰੇਰੀ ਖੋਲ੍ਹਣ ਅਤੇ ਪਿੰਡ ਪੱਧਰ 'ਤੇ ਜੋ ਲੋਕ ਕਲਾਵਾਂ ਹਨ ਸਾਡੇ ਵਿਰਸੇ ਨਾਲ ਬੱਚਿਆਂ ਨੂੰ ਜੋੜਨ